ਸਥਾਨਕ ਕਲਾਕਾਰ ਆਪਣੇ ਵੱਖ ਵੱਖ ਤਰੀਕਿਆਂ ਨਾਲ਼ ਸਥਾਨ ਅਤੇ ਰਾਜ ਦੀ ਕਲਾ ਅਤੇ ਸੱਭਿਆਚਾਰ ਉੱਤੇ ਆਪਣਾ ਭਰਪੂਰ ਯੋਗਦਾਨ ਪਾਉਂਦੇ ਹਨ ਇਹ ਇਸ ਗੱਲ ਲੋਕਾਂ ਦੇ ਦਿਲਾਂ 'ਚ ਹਮੇਸ਼ਾ ਵਸੇ ਰਹਿੰਦੇ ਹਨ ਅਤੇ ਲੋਕ ਇਹਨਾਂ ਦੇ ਅਨੁਸਾਰ ਹੀ ਚੱਲਣ ਦੀ ਕੋਸ਼ਿਸ਼ ਕਰਦੇ ਹਨ ਇਹ ਧਾਰਮਿਕ ਸਮਾਗਮਾਂ ਵਿੱਚ ਹਿੱਸਾ ਲੈਂਦੇ ਹਨ ਕਈ ਮੇਲੇ ਤਿਉਹਾਰਾਂ ਵਿੱਚ ਇਹ ਆਪਣੇ ਕਲਾ ਦਾ ਯੋਗਦਾਨ ਪਾਉਂਦੇ ਹਨ ਇਹ ਆਪਣੀ ਤਰੀਕਿਆਂ ਨਾਲ਼ ਸਮਾਜ ਉੱਤੇ ਇੱਕ ਵੱਖਰਾ ਅਮਿੱਟ ਛਾਪ ਛੱਡਦੇ ਹਨ ਜਿਸਦਾ ਕਿਸ਼ੋਰ ਅਵਸਥਾ ਵਾਲੇ ਨੌਜਵਾਨਾਂ ਅਧਖੜ੍ਹ ਉਮਰ ਦੇ ਨੌਜਵਾਨਾਂ ਉੱਤੇ ਜ਼ਿਆਦਾ ਅਸਰ ਪੈਂਦਾ ਹੈ ਇਹ ਆਪਣੀ ਧਾਰਮਿਕ ਬੋਲੀਆਂ ਨਾਲ਼ ਬਜ਼ੁਰਗਾਂ ਦਾ ਧਿਆਨ ਵੀ ਆਪਣੇ ਵੱਲ੍ਹ ਖਿੱਚਦੇ ਹਨ ਪਿੰਡ ਦੀਆਂ ਸੁਆਣੀਆਂ ਉਹਨਾਂ ਦੇ ਕੰਮ ਕਾਜ ਬਾਰੇ ਇਹ ਆਪ ਸਟੇਜ ਉੱਤੇ ਸਭ ਨੂੰ ਦੱਸਦੇ ਹਨ ਜਿਸ ਨਾਲ਼ ਸਮਾਜ ਇੱਕ ਵਧੀਆ ਦਿਸ਼ਾ ਵਿੱਚ ਜਾਂਦਾ ਹੈ